ਸਤਿ ਸ੍ਰੀ ਅਕਾਲ ਮੈਂ ਅਰਪਿਤਾ ਬੋਲ ਰਹੀ ਹਾਂ ਮੈਂ ਸੇਨ ਜੋਸਫ ਸਕੂਲ ਤੋਂ ਬੋਲ ਰਹੀ ਹਾਂ ਮੈਂ ਵਧੀਆ ਵਾਂ ਮੈਂ ਸਕੂਲੋਂ ਆਈ ਹਾਂ ਕੰਮ ਕਰਕੇ ਹਾਂਜੀ ਮੈਡਮ ਦੱਸੋ ਕੀ ਕਹਿਣਾ ਚਾਹੁੰਦੇ ਹੋ ਮੈਡਮ ਜੀ ਇਹ ਤਾਂ ਗੱਲ ਤੁਸੀਂ ਸਹੀ ਕਹਿ ਰਹੇ ਹੋ ਕਿ ਜਿੰਨਾ ਸਾਡੇ ਕੋਲ ਕੰਮ ਲਿਤਾ ਜਾਂਦਾ ਉਹਨਾਂ ਸਾਨੂੰ ਦਿੱਤਾ ਨਹੀਂ ਜਾਂਦਾ ਨਾਲੇ ਅੱਜ ਕੱਲ੍ਹ ਦੇ ਆਨਲਾਈਨ ਜਿਹੜਾ ਜ਼ਮਾਨਾ ਆ ਗਿਆ ਉਹਦੇ 'ਚ ਟੀਚਰਾਂ ਨੂੰ ਸਕੂਲ 'ਚ ਅਤੇ ਕੰਮ ਕਰਨਾ ਹੀ ਪੈਂਦਾ ਅਤੇ ਘਰ ਰੱਖ ਕੇ ਵੀ ਉਹਨਾਂ ਨੂੰ ਕਈ ਜ਼ਿੰਮੇਵਾਰੀ ਹੁੰਦੀਆਂ ਜੋ ਨਿਭਾਉਣੀਆਂ ਪੈਂਦੀਆਂ ਹਾਂਜੀ ਸਰਕਾਰ ਮੇਰੇ ਹਿਸਾਬ ਨਾਲ ਮਦਦ ਕਰਦੀ ਵੀ ਹੈਗੀ ਹੈ ਅਤੇ ਉਹਨੂੰ ਮਦਦ ਕਰਨੀ ਹੋਰ ਚਾਹੀਦੀ ਹੈਗੀ ਹੈ ਉਹਨੂੰ ਟੀਚਰਾਂ ਨੂੰ ਹੋਰ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਦਾ ਥੋੜ੍ਹਾ ਭਾਰ ਘਟਾ ਦੇਣਾ ਚਾਹੀਦਾ ਹੋਰ ਟੀਚਰਾਂ ਵਧੀ ਵੱਖਰੇ ਵੱਖਰੇ ਕੰਮਾਂ ਵਾਸਤੇ ਲਾ ਕੇ ਤੁਸੀਂ ਮੰਨੋਗੇ ਇਹ ਗੱਲ ਹਾਂਜੀ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਨੇ ਹੁਣ ਤੱਕ ਕੀ ਕੀਤਾ ਇੱਦਾਂ ਦਾ ਕੀ ਟੀਚਰਾਂ ਦਾ ਹਾਲੇ ਵੀ ਮਦਦ ਹੋ ਰਹੀ ਹੈਗੀ ਹੈ ਇਹ ਤਾਂ ਗੱਲ ਮੈਡਮ ਜੀ ਤੁਸੀਂ ਸਹੀ ਕਹਿ ਰਹੇ ਹੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਵੀ ਹੁੰਦੀ ਆ ਕਿ ਸਰਕਾਰ ਕਰ ਵੀ ਰਹੀ ਆ ਬਹੁਤ ਸਾਰੇ ਇੱਦਾਂ ਦੇ ਪ੍ਰੋਗਰਾਮ ਜਿਹਨਾਂ ਨਾਲ ਸਾਨੂੰ ਬੜੀ ਮਦਦ ਮਿਲਦੀ ਹੈਗੀ ਆ ਮੈਨੂੰ ਲੱਗਦਾ ਕਿ ਇਹ ਬਹੁਤ ਵੱਡਾ ਵਿਸ਼ੇ ਹੋਣ ਵਾਲਾ ਅਤੇ ਮੈਂ ਇਹ ਚਾਹੁੰਦੀ ਆ ਕਿ ਤੁਸੀਂ ਮੇਰੇ ਘਰ ਸ਼ਾਮੀ ਪੰਜ ਵਜੇ ਆਓ ਅਸੀਂ ਇਹਦੇ ਨਾਲ ਵਧੀਆ ਗੱਲਾਂ ਕਰੀਏ ਇਹਦੇ ਬਾਰੇ ਹੋਰ ਅਸੀਂ ਜਾਣਕਾਰੀ ਲਈ

ਧੰਨਵਾਦ